ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਤਪਾਲ ਸਿੰਘ ਬੋਲਦਾਂ ਆ ਜੀ ਮੈਂ ਤੁਹਾਡੇ ਸਵੀਗੀ ਤੋਂ ਓਡਰ ਕਰਿਆ ਸੀਗਾ ਹਾਊਸ ਨੰਬਰ ਸਤਾਰ੍ਹਾਂ ਏਡੀ ਵਾਰਡ ਨੰਬਰ ਪੰਦਰਾਂ ਨੰਗਲ ਰੋਡ ਰੋਪੜ ਤੋਂ ਜੀ ਅਤੇ ਤੁਹਾਡਾ ਜਿਹੜਾ ਡਿਲਵਰੀ ਬੋਏ ਸੀਗਾ ਉਹਨੇ ਬੜੀ ਵਧੀਆ ਸਰਵਿਸ ਦਿੱਤੀ ਜੀ ਟਾਈਮ ਤੋਂ ਹੀ ਪਹਿਲਾਂ ਪੁੱਜਿਆ ਅਤੇ ਜਿਹੜਾ ਮੈਂ ਪੀਜ਼ਾ ਬਰਗਰ ਅਤੇ ਹੋਰ ਵੀ ਕੁਝ ਮੰਗਾਇਆ ਸੀਗਾ ਜਿਹਦੇ ਵਿੱਚ ਮੋਮੋਸ ਸੀਗੇ ਟੈਕੋ ਸੀਗਾ ਉਹ ਵੀ ਐਨ ਗਰਮ ਸੀਗਾ ਅਤੇ ਬੜੀ ਵਧੀਆ ਸਰਵਿਸ ਸੀਗੀ ਤੁਹਾਡੀ ਤੁਹਾਡੇ ਡਿਲਵਰੀ ਬੋਏ ਦੀ ਵੀ ਜੀ ਬਹੁਤ ਵਧੀਆ ਲੱਗਿਆ ਮੇਰੇ ਰਿਸ਼ਤੇਦਾਰ ਵੀ ਆਏ ਵੇ ਸੀਗੇ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਮੇਰੇ ਫ ਘਰਦਿਆਂ ਨੂੰ ਮੇਰੇ ਪਰਿਵਾਰ ਨੂੰ ਵੀ ਬਹੁਤ ਪਸੰਦ ਆਇਆ ਅੱਗੇ ਤੋਂ ਜਿਹੜੇ ਵੀ ਓਰਡਰ ਹੋਣਗੇ ਜੀ ਤੁਹਾਡੇ ਕੋਲੋਂ ਹੀ ਓਰਡਰ ਕਰਵਾਏ ਜਾਵਾਂਗੇ ਜੀ ਤੁਹਾਡੀ ਡਿਲਵਰੀ ਦਾ ਟਾਈਮ ਵੀ ਬਹੁਤ ਵਧੀਆ ਜੀ ਸਾਰਾ ਕੁਛ ਬਹੁਤ ਵਧੀਆ ਅਤੇ ਸਾਰਾ ਜਿੰਨਾਂ ਵੀ ਖਾਣਾ ਸੀਗਾ ਉਹ ਵੀ ਬੜਾ ਸਵਾਦ ਸੀਗਾ ਸ਼ੁਕਰੀਆ ਜੀ ਧੰਨਵਾਦ